ਮਨੁੱਖ ਨੂੰ ਤਣਾਅ ਤੋਂ ਮੁਕਤ ਕਰਨ ਲਈ ਖੇਡਾਂ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਆ ਇਹਨਾਂ ਦੀ ਪੁਰਾਤਨ ਸਮੇਂ ਤੋਂ ਜਿਹੜੇ ਪੰਜਾਬ ਦੇ ਵਿੱਚ ਖੇਡਾਂ ਚੱਲਦੀਆਂ ਰਹੀਆਂ ਹੈ ਜਿਵੇਂ ਕੁਸ਼ਤੀ ਘੋਲ ਕਬੱਡੀ ਆਦਿ ਹੁਣ ਤਾਂ ਲੋਕ ਕ੍ਰਿਕਟ ਫੁੱਟਬੋਲ ਜਾਂ ਬੈਡਮਿੰਟਨ ਵਗੈਰਾ ਵੀ ਖੇਡਦੇ ਆ ਇਹਨਾਂ ਖੇਡਾਂ ਨਾਲ ਇੱਕ ਤਾਂ ਜਿੱਥੇ ਸਿਹਤ ਚੰਗੀ ਰਹਿੰਦੀ ਆ ਰਲ ਮਿਲ ਕੇ ਲੋਕ ਰਹਿੰਦੇ ਆ ਉੱਥੇ ਇਹਨਾਂ ਨੂੰ ਵੇਖਣ ਵਾਲੇ ਵੀ ਕਾਫੀ ਦਰਸ਼ਕ ਆਉਂਦੇ ਆ ਜਿਹੜੇ ਕਿ ਇਕੱਠੇ ਬੈਠਦੇ ਆ ਪ੍ਰੇਮ ਪਿਆਰ ਵੱਧਦਾ ਉਹਨਾਂ ਦੇ ਵਿੱਚ ਜਦੋਂ ਖੇਡ ਖਿਡਾਰੀ ਖੇਡ ਰਹੇ ਹੁੰਦੇ ਆ ਅਤੇ ਮਨੋਰੰਜਨ ਦਾ ਵੀ ਬਹੁਤ ਕੰਮ ਕਰਦੀਆਂ ਵਾ ਖੇਡਾਂ ਅਤੇ ਵੇਖਣ ਵਾਲਿਆਂ ਨੂੰ ਬਹੁਤ ਜਿਹੜਾ ਖੁਸ਼ੀ ਮਿਲਦੀ ਆ ਇਹਦੇ ਵਿੱਚ ਜ਼ਿਆਦਾਤਰ ਜਿਹੜੇ ਆ ਇਹਨਾਂ ਨਾਲ ਜਿਹੜੇ ਨਸ਼ਿਆਂ ਤੋਂ ਬੱਚੇ ਜਿਹੜੇ ਬਚ ਜਾਂਦੇ ਆ ਅਤੇ ਉਹਨਾਂ ਦੇ ਵਿੱਚ ਸਰੀਰਕ ਜਿਹੜਾ ਤੰਦਰੁਸਤੀ ਵੀ ਰਹਿੰਦੀ ਹੈ ਖੇਡਾਂ ਦੇ ਨਾਲ ਆਪਣਾ ਉਹਨਾਂ ਦਾ ਖਿਆਲ ਆ ਅਤੇ ਜਿਹੜੇ ਉਹ ਚੰਗੀ ਇੱਕ ਅਸ ਉਸਾਰੂ ਸੋਚ ਵੱਧਦੀ ਆ ਉਹਦੇ ਨਾਲ ਅਤੇ ਇਹਦੇ ਕਾਰਨ ਆ ਵੀ ਖੇਡਾਂ ਜਿਹੜੀਆਂ ਵਾ ਇਹ ਬਹੁਤ ਜ਼ਿਆਦਾ ਵਧੀਆ ਮਨੋਰੰਜਨ ਦਾ ਸਾਧਨ ਕਰਦੀਆਂ ਵਾ ਅਤੇ ਤਣਾਅ ਵੀ ਬੰਦੇ ਦਾ ਦੂਰ ਹੋ ਜਾਂਦਾ ਖੇਡਾਂ ਦੇ ਵਿੱਚ ਜਦੋਂ ਖੇਡਦੇ ਖਿਡਾਰੀ ਤਾਂ ਉਹਨਾਂ ਦੇ ਵਿੱਚ ਆਪਸੀ ਮਿਲਵਰਤਨ ਆਪਸੀ ਭਾਈਚਾਰਾ ਜਿਹੜਾ ਉਹਦੀ ਸਾਂਝ ਵੀ ਵੱਧਦੀ ਆ